ਵਧੀਆ ਵਧੀਆ ਰੋਹਿਤ ਹੋਰ ਸੁਣਾ ਕਿਵੇਂ ਆ ਕਿੱਥੇ ਸੀ ਮੈਂ ਕਿੱਥੇ ਜਾਣਾ ਮੈਂ ਇੱਥੇ ਸੀਗਾ ਤੂੰ ਸੁਣਾ ਓਹ ਬਸ ਕੰਮ ਦੇ ਵਿੱਚ ਬਿਜ਼ੀ ਹੋ ਗਏ ਅਤੇ ਤਾਂ ਕਰਕੇ ਹੋਰ ਕਿੱਥੇ ਸੀਗਾ ਫਿਰ ਇੱਥੇ ਫਰੀਦਕੋਟ ਹਾਂ ਆਜਾ ਬੇਫਿਕਰ ਆਜਾ ਕੋਈ ਨਹੀਂ ਠੀਕ ਹੈ ਪਹੁੰਚ ਜਾ ਆਪਾਂ ਦੇਖਦੇ ਹਾਂ ਫਿਰ ਹਾਂ ਹਾਂ ਦੱਸ ਹਮ ਗੱਲ ਤਾਂ ਸਹੀ ਏ ਤੇਰੀ ਹਮ ਕ ਹਾਂ ਹਾਂ ਕੋਈ ਨਹੀਂ ਲੈ ਤੂੰ ਆ ਅਤੇ ਪਹੁੰਚ ਤੈਨੂੰ ਸਾਰਾ ਫਰੀਦਕੋਟ ਘੁੰਮਾ ਦਿੰਦੇ ਆ ਹਾਂ ਹਾਂ ਕੱਲ੍ਹ ਮੈਂ ਫਰੀ ਹਾਂ ਬੇਫਿਕਰ ਹੋ ਕੇ ਸਾਰਾ ਦਿਨ ਆਪਾਂ ਫਿਰ ਆਪਾਂ ਫਰੀਦਕੋਟ ਘੁੰਮਣ ਆਏਗਾ ਤਾਂ ਫਰੀਦਕੋਟ ਹੀ ਘੁੰਮਾਂਗੇ ਫਰੀਦਕੋਟ 'ਚ ਹੈਗਾ ਕਾਫੀ ਚੀਜ਼ਾਂ ਨੇ ਘੁੰਮਣ ਵਾਲੀਆਂ ਫਰੀਦਕੋਟ ਦੇ ਵਿੱਚ ਤੂੰ ਵੈਸੇ ਹੀ ਤੂੰ ਗੱਲ ਕੀਤੀ ਅਤੇ ਇਹ ਸੀਗਾ ਕਿ ਇੱਥੇ ਸੀਗੇ ਬਾਬਾ ਫਰੀਦ ਜੀ ਸੀਗੇ ਕਾਫੀ ਟਾਈਮ ਮਤਲਬ ਕਿ ਉਹ ਇੱਥੇ ਰਹੇ ਨੇ ਕਾਫੀ ਉਹਨਾਂ ਨੇ ਕੰਮ ਵਗੈਰਾ ਕੀਤਾ ਇੱਥੇ ਸੇਵਾ ਵਗੈਰਾ ਕੀਤੀ ਹੈ ਅਤੇ ਉਹਨਾਂ ਦੇ ਨਾਮ 'ਤੇ ਸ਼ਹਿਰ ਦਾ ਨਾਮ ਪਿਆ ਪਹਿਲਾਂ ਤਾਂ ਇਹ ਸੀਗਾ ਕਿ ਇਹਨੂੰ ਫਰੀਦ ਨਗਰੀ ਕਹਿੰਦੇ ਸੀਗੇ ਬਟ ਬਾਅਦ 'ਚ ਫਿਰ ਹਾਂ ਬਾਅਦ ਦੇ ਵਿੱਚ ਫਿਰ ਟਾਈਮ ਦੇ ਹਿਸਾਬ ਨਾਲ ਫਿਰ ਚੇਂਜ ਹੋ ਕੇ ਅਤੇ ਇਹਦਾ ਨਾਮ ਫਰੀਦਕੋਟ ਰੱਖ ਤਾ ਹਾਂ ਜਿੱਥੇ ਉਹ ਮਤਲਬ ਕਿ ਸਾਰਿਆਂ ਸਾਰੀ ਜ਼ਿੰਦਗੀ ਆਪਣੀ ਉਹਨਾਂ ਨੇ ਬਿਤਾਈ ਆ ਅਤੇ ਉਹਨਾਂ ਦੇ ਨਾਮ 'ਤੇ ਇੱਥੇ ਗੁਰਦੁਆਰਾ ਹੈਗਾ ਆਪਣਾ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਜੀ ਦੇ ਨਾਮ 'ਤੇ ਹਾਂ ਬਿਲਕੁਲ ਸਭ ਤੋਂ ਪਹਿਲਾਂ ਉੱਥੇ ਜਾਵਾਂਗੇ ਬਾਬਾ ਫਰੀਦ ਦੇ ਗੁਰਦੁਆਰੇ ਜਾਵਾਂਗੇ ਅਤੇ ਲੰਗਰ ਵਗੈਰਾ ਛਕਾਂਗੇ ਠੀਕ ਹੈ ਉਸ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਫਿਰ ਆਪਣਾ ਗੋਦੜੀ ਸਾਹਿਬ ਵੀ ਆਪਣਾ ਗੁਰਦੁਆਰਾ ਹੈਗਾ ਕੋਟਕਪੁਰਾ ਰੋਡ 'ਤੇ ਅਤੇ ਹਾਂ ਰਾਜੇ ਦਾ ਮਹਿਲ ਵੀ ਹੈਗਾ ਬਟ ਇਸ ਟਾਈਮ 'ਤੇ ਇਹ ਹੈ ਕਿ ਉੱਥੇ ਕੰਮ ਚੱਲ ਰਿਹਾ ਮਹਿਲ ਦੇ ਵਿੱਚ ਅੰਦਰ ਅਤੇ ਹਾਂ ਉੱਥੇ ਜਾਣਾ ਥੋੜ੍ਹਾ ਹਜੇ ਮੁਸ਼ਕਿਲ ਹੈ ਬਟ ਇਹ ਹੈ ਕਿ ਹਾਂ ਜਿੰਨਾਂ ਘੁੰਮਾ ਸਕਦਾ ਮੈਂ ਤੈਨੂੰ ਬਾਹਰੋਂ ਜੋ ਆਪਣਾ ਦੇਖ ਸਕਦੇ ਆ ਆਪਾਂ ਅਤੇ ਹਾਂ ਹਾਂ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਫਿਰ ਇੱਥੇ ਨਹਿਰਾਂ ਵਗੈਰਾ ਹੈਗੀਆਂ ਨੇ ਉੱਥੇ ਆਪਾਂ ਚਲ ਵੜਾਂਗੇ ਠੰਡੀ ਹਵਾ ਵਗੈਰਾ ਖਾ ਆਵਾਂਗੇ ਵਧੀਆ ਆਪਦਾ ਹਵਾ

ਹਾਂ ਹਾਂ ਬਿਲਕੁਲ ਤੂੰ ਮੈਨੂੰ ਫੋਨ ਕਰਦੀ ਅਤੇ ਮੈਂ ਪਹੁੰਚ ਜੂਗਾ ਚੱਲ ਠੀਕ ਹੈ ਓਕੇ ਜਨਾਬ ਓਕੇ ਓਕੇ